ਸਤਿ ਸ਼੍ਰੀ ਅਕਾਲ ਸਰ ਮੈਂ ਤੁਹਾਤੋਂ ਅੱਗੇ ਵੀ ਅਮਜੋਨ ਤੋਂ ਕਾਫੀ ਸ਼ੋਪਿੰਗ ਕਰਦੀ ਹਾਂ ਔਨਲਾਈਨ ਪਰ ਇਸ ਵਾਰ ਮੈਂ ਜੋ ਸੁਨ ਤੋਂ ਇੱਕ ਪਰਸ ਮੰਗਵਾਇਆ ਸੀ ਲੈਦਰ ਦਾ ਉਹ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਆਇਆ ਜੋ ਚੀਜ਼ ਮੈਂ ਤੁਹਾਡੀ ਮਤਲਬ ਸਾਈਟ 'ਤੇ ਦੇਖੀ ਸੀ ਉਹ ਉਸ ਤੋਂ ਬਿਲਕੁਲ ਹਟ ਕੇ ਹੈ ਕਿਉਂਕਿ ਇਹ ਉਹ ਮਤਲਬ ਹੈ ਹੀ ਨਹੀਂ ਮਟੀਰੀਅਲ ਇਹਦੇ ਵਿੱਚ ਲੈਦਰ ਬਹੁਤ ਘਟੀਆ ਲੱਗ ਰਿਹਾ ਮੈਨੂੰ ਅਤੇ ਇਸ ਦਾ ਕਲਰ ਵੀ ਉਸ ਤਰ੍ਹਾਂ ਦਾ ਨਹੀਂ ਹੈਗਾ ਜਿਸ ਤਰ੍ਹਾਂ ਦਾ ਮੈਨੂੰ ਉਸ 'ਤੇ ਸ਼ੋ ਹੋ ਰਿਹਾ ਸੀ ਅਤੇ ਜੋ ਮਤਲਬ ਡਿਜ਼ਾਇਨ ਵਗੈਰਾ ਵੀ ਦੇਖਿਆ ਸੀ ਉਸ ਤੋਂ ਵੀ ਥੋੜ੍ਹਾ ਜਿਹਾ ਮਤਲਬ ਫਰਕ ਲੱਗ ਰਿਹਾ ਮਤਲਬ ਕੁੱਲ ਮਿਲਾ ਕੇ ਮੈਨੂੰ ਇਹ ਲੱਗ ਰਿਹਾ ਵੀ ਇਹ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਆ ਜਿਸ ਤਰ੍ਹਾਂ ਤੁਸੀਂ ਮਤਲਬ ਅੱਗੇ ਤੁਹਾਡੇ ਉਸ ਨਾਲ ਮੈਂ ਡੀਲਿੰਗ ਕਰਦੀ ਹਾਂ ਅਸੀਂ ਚੀਜ਼ ਮੰਗਵਾਉਂਦੇ ਹਾਂ ਵਧੀਆ ਨਿਕਲਦੀ ਹੈ ਪਰ ਇਸ ਵਾਰ ਤੁਸੀਂ ਮੈਨੂੰ ਬਹੁਤ ਘਟੀਆ ਚੀਜ਼ ਭੇਜੀ ਹੈ ਜੋ ਕਿ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਆ ਰਹੀ ਕਿਸੇ ਵੀ ਤਰ੍ਹਾਂ ਔਰ ਮੈਂ ਆਪਣੇ ਇੱਕ ਦੋ ਫਰੈਂਡਸ ਨੂੰ ਵੀ ਸਹੇਲੀਆਂ ਨੂੰ ਵੀ ਦਿਖਾਈ ਹੈ ਉਹਨਾਂ ਨੇ ਵੀ ਇਸ ਨੂੰ ਬਿਲਕੁਲ ਪਸੰਦ ਨਹੀਂ ਕਰਿਆ ਔਰ ਮੈਂ ਤਾਂ ਇਹ ਸੋਚਿਆ ਸੀ ਵੀ ਮੈਨੂੰ ਵਧੀਆ ਲੱਗੇਗੀ ਤਾਂ ਮੈਂ ਹੋਰਾਂ ਵਾ ਨੂੰ ਵੀ ਅੱਗੇ ਮੰਗਵਾ ਕੇ ਦੇਵਾਂਗੀ ਪਰ ਇਹ ਤਾਂ ਮੈਂ ਬਿਲਕੁਲ ਵੀ ਉਹ ਚੀਜ਼ ਹੈ ਹੀ ਨਹੀਂ ਜੋ ਤੁਸੀਂ ਮੈਨੂੰ ਦਿਖਾ ਰਹੇ ਸੀਗੇ ਇਸ ਲਈ ਮੈਨੂੰ ਇਹ ਪਸੰਦ ਨਹੀਂ ਆ ਰਹੀ ਚੀਜ਼ ਤਾਂ ਇਸਨੂੰ ਜਾਂ ਤਾਂ ਵਾਪਸ ਕਰ ਲਓ ਪਰ ਮੇਰੇ ਪੈਸੇ ਵਾਪਸ ਕਰ ਦਿਉ ਜਾਂ ਇਸ ਨੂੰ ਤੁਸੀਂ ਬਦਲ ਕੇ ਜੋ ਚੀਜ਼ ਤੁਸੀਂ ਮੈਨੂੰ ਦਿਖਾਈ ਸੀ ਉਹ ਚੀਜ਼ ਮੈਨੂੰ ਮਤਲਬ ਭੇਜੋ ਅਤੇ ਵੈਸੇ ਤਾਂ ਮੈਨੂੰ ਨਹੀਂ ਲੱਗ ਰਿਹਾ ਵੀ ਉਹ ਚੀਜ਼ ਤੁਸੀਂ ਜੋ ਦਿਖਾ ਰਹੇ ਹੋ ਉਹ ਮਿਲੇਗੀ ਮੈਨੂੰ ਇਸ ਲਈ ਹੋ ਸਕੇ ਤਾਂ ਮੈਨੂੰ ਮੇਰੇ ਪੈਸੇ ਹੀ ਵਾਪਸ ਭੇਜ ਦਿਉ ਰਿਫੰਡ ਕਰ ਦਿਉ ਨਹੀਂ ਅਦਰਵਾਈਜ਼ ਮੈਂ ਇਸ ਦੀ ਸ਼ਿਕਾਇਤ ਤੁਹਾਨੂੰ ਪਤਾ ਵੀ ਮੈਨੂੰ ਕਰਨੀ ਪਵੇਗੀ ਕਿਉਂਕਿ ਮੈਨੂੰ ਜੋ ਚੀਜ਼ ਚਾਹੀਦੀ ਉਹ ਮੈਨੂੰ ਮਿਲ ਹੀ ਨਹੀਂ ਰਹੀ ਅਤੇ ਫਿਰ ਮੈਂ ਕਿਉਂ ਇਸ ਨੂੰ ਇਸਤੇਮਾਲ ਕਰਾਂ